ਮੈਂ ਅਕਸਰ ਹੀ ਮੇਰੀ ਜ਼ਿੰਦਗੀ ਦੇ ਵਿੱਚ ਕੋਂਪੀਟੀਸ਼ਨ ਦੇ ਵਿੱਚ ਪਾਰਟੀਸੀਪੇਟ ਕਰਦੀ ਰਹਿੰਦੀ ਹਾਂ ਅਤੇ ਮੈਂ ਕਈ ਸਿੰਗਿੰਗ ਕੋਂਪੀਟੀਸ਼ਨਾਂ ਦੇ ਵਿੱਚ ਪਾਰਟੀਸਪੇਟ ਕੀਤਾ ਹੈ ਅਤੇ ਕਈ ਕੋਂਪੀਟੀਸ਼ਨ ਇਹੋ ਜਿਹੇ ਵੀ ਹੁੰਦੇ ਹਨ ਜਿਹੜੇ ਕਿ ਮੇਰੇ ਟੀਚਰਸ ਦੇ ਦੁਆਰਾ ਮੈਨੂੰ ਕਹੇ ਜਾਂਦੇ ਹਨ ਅਤੇ ਮੈਨੂੰ ਕਰਨੇ ਹੀ ਪੈਂਦੇ ਹਨ ਮੇਰਾ ਫਸਟ ਮੈਂ ਟੈਂਨਥ ਕਲਾਸ ਦੇ ਵਿੱਚ ਸੀ ਜਦੋਂ ਕਿ ਮੇਰੇ ਫੇਵਰੇਟ ਟੀਚਰ ਨੇ ਮੈਨੂੰ ਇੱਕ ਸੌਂਗ ਗਾਉਣ ਦੇ ਲਈ ਸਟੇਜ 'ਤੇ ਸੱਦਿਆ ਉਸ ਟਾਈਮ ਉਹ ਮੇਰਾ ਫਸਟ ਐਕਸਪੀਰੀਅਂਸ ਸੀ ਸਟੇਜ 'ਤੇ ਐਂਡ ਮੈਂ ਕਾਫ਼ੀ ਨਰਵਸ ਫੀਲ ਕਰ ਰਹੀ ਸੀ ਉਸ ਟਾਈਮ ਮੈਂ ਉਸ ਟਾਈਮ ਗੁਰੂ ਗੋਬਿੰਦ ਸਿੰਘ ਜੀ ਦੇ ਰਿਲੇਟਡ ਗੁਰੂ ਸੌਂਗ ਹੀ ਗਾਇਆ ਸੀ ਮੇਰੀ ਆਵਾਜ਼ ਸੁਣ ਕੇ ਕਾਫ਼ੀ ਸਟੂਡੈਂਟ ਬਹੁਤ ਵਧੀਆ ਫੀਲ ਕਰ ਰਹੇ ਸਨ ਅਤੇ ਇਹ ਮੇਰੇ ਟੀਚਰ ਦੇ ਦੁਆਰਾ ਚੁੱਕਿਆ ਹੋਇਆ ਮੇਰੇ ਲਈ ਫਸਟ ਕਦਮ ਸੀ ਜਿਹੜਾ ਕਿ ਅੱਜ ਵੀ ਮੇਰੀ ਲਾਈਫ ਦੇ ਵਿੱਚ ਬਹੁਤ ਮਹੱਤਵਪੂਰਨ ਹੈ ਅਤੇ ਇਹ ਕਦਮ ਮੈਨੂੰ ਅੱਗੇ ਵੱਧਣ ਦੇ ਲਈ ਮੋਟੀਵੇਟ ਕਰਦਾ ਹੈ ਅਤੇ ਉਸ ਉਸ ਟਾਈਮ ਮੈਂ ਸਟੇਜ 'ਤੇ ਚੜ ਕੇ ਕਾਫ਼ੀ ਨਰਵਸ ਫੀਲ ਕੀਤਾ ਪਰ ਫਿਰ ਮੈਂ ਕਾਫ਼ੀ ਵਧੀਆ ਫੀਲ ਕੀਤਾ